ਪੰਜਾਬ ਦੇ ਪਿੰਡਾਂ ਦੇ ਰਵਾਇਤੀ ਘਰਾਂ ਦੀ ਵਿਆਖਿਆ ਅੱਗੇ ਪਿੰਡਾਂ ਦੇ ਵਿੱਚ ਕੱਚੇ ਘਰ ਬਣਾਏ ਜਾਂਦੇ ਸੀ ਪਹਿਲਾਂ ਤੋਂ ਪਾਲੀ ਦੀਆਂ ਛੱਪੜਾਂ 'ਚੋਂ ਇੱਟਾਂ ਕੱਢ ਕੇ ਉਹਨਾਂ ਦੇ ਬਣਾਏ ਜਾਂਦੇ ਸੀ ਹੌਲੀ ਹੌਲੀ ਲੋਕ ਕੱਚੀਆਂ ਇੱਟਾਂ ਬਣਾ ਕੇ ਉਹਨਾਂ ਦੇ ਘਰ ਬਣਾਉਣ ਲੱਗ ਗਏ ਕੱਚੇ ਘਰ ਬਹੁਤ ਠੰਢੇ ਹੁੰਦੇ ਸੀ ਅਤੇ ਉਹਨਾਂ ਦੇ ਵਿੱਚ ਜਨੌਰਾਂ ਦੇ ਰਹਿਣ ਦੀ ਵੀ ਜਗ੍ਹਾ ਬਣ ਜਾਂਦੀ ਸੀ ਹੁਣ ਆਪਾਂ ਛੱਤਾਂ ਪੱਕੀਆਂ ਕਰ ਦਿੰਦੇ ਹਾਂ ਉਹਨਾਂ ਦੇ ਵਿੱਚ ਜਾਨਵਰਾਂ ਦੇ ਰਹਿਣ ਦੀ ਵੀ ਕੋਈ ਥਾਂ ਨਹੀਂ ਹੁੰਦੀ ਇਸ ਕਰਕੇ ਹੁਣ ਆਪਾਂ ਏ ਸੀ ਵੀ ਲਾ ਲੈਂਦੇ ਹੁੰਦੇ ਉੱਨੇ ਠੰਢੇ ਨਹੀਂ ਹੁੰਦੇ ਅੱਗੇ ਬਿਨਾਂ ਏਸੀਆਂ ਤੋਂ ਵੀ ਲੋਕ ਕੱਚੇ ਘਰਾਂ ਦੇ ਵਿੱਚ ਰਹਿੰਦੇ ਸੀ ਲੇਡੀਜ਼ ਲਿੱਪ ਕੇ ਰੱਖਦੀਆਂ ਸੀ ਬਹੁਤ ਸੋਹਣਾ ਵਿੱਚ ਉੱਤੇ ਚਿੱਤਰਕਾਰੀ ਕਰਦੀਆਂ ਸੀ ਉਹਨਾਂ ਨੂੰ ਪੋਚ ਕੇ ਰੱਖਿਆ ਜਾਂਦਾ ਸੀ ਇਸ ਤਰ੍ਹਾਂ ਕਰਕੇ ਵੀ ਬਹੁਤ ਵਧੀਆ ਵਧੀਆ ਘਰ ਬਣੇ ਹੁੰਦੇ ਸੀ ਸਾਰਾ ਕੰਮ ਜਿਹੜਾ ਲੇਡੀਜ਼ ਆਪ ਹੀ ਬਣਾਉਂਦੀਆਂ ਸੀ ਜਿਵੇਂ ਕੱਚੀਆਂ ਇੱਟਾਂ ਲਗਾ ਲਗਾ ਕੇ ਪੌੜੀਆਂ ਬਣਾਉਣੀਆਂ ਉੱਪਰ ਚੁਬਾਰੇ ਬਣਨੇ ਸਾਰਾ ਕੁਛ ਉਵੇਂ ਹੀ ਹੁੰਦਾ ਸੀ ਪਰ ਬਹੁਤ ਠੰਢਾ ਅਤੇ ਵਾਤਾਵਰਨ ਵਧੀਆ ਹੁੰਦਾ ਸੀ ਉਸ ਦੇ ਮੁਕਾਬਲੇ ਹੁਣ ਆਪਣਾ ਵਾਤਾਵਰਨ ਬਹੁਤ ਹੀ ਮਤਲਬ ਗਰਮ ਹੋ ਗਿਆ ਹੈ ਹੁਣ ਸਗੋਂ ਇਸ ਤਰ੍ਹਾਂ ਲੱਗਦਾ ਕਿ ਵੀ ਜਿਹੜੇ ਪਹਿਲਾਂ ਵਾਲੇ ਘਰ ਸੀ ਉਹ ਸਮਾਂ ਵਧੀਆ ਸੀ ਵੀ ਸਾਨੂੰ ਉਸ ਤਰ੍ਹਾਂ ਦੇ ਹੀ ਬਣਾਉਣੇ ਚਾਹੀਦੇ ਆ ਪਰ ਅੱਜ ਕੱਲ੍ਹ ਜੋ ਸਮਾਜ ਦਾ ਬਣਿਆ ਪਿਆ ਵੀ ਲੋਕਾਂ ਨੂੰ ਦੇਖੋ ਦੇਖੀ ਵੀ ਪੱਕੇ ਘਰ ਉਸਾਰੀ ਜਾਂਦੇ ਆ ਉਹਨਾਂ ਦੇ ਵਿੱਚ ਰਹਿਣਾ ਸਗੋਂ ਔਖਾ ਹੋ ਜਾਂਦਾ ਇਸ ਕਰਕੇ ਸਾਨੂੰ ਪਿਛਲੇ ਰਵਾਇਤੀ ਘਰਾਂ ਵੱਲ ਜਾਣਾ ਚਾਹੀਦਾ